ਹੈਲੋ ਅਸੀਂ ਅੱਜ ਸਾਡੀ ਬੇਟੀ ਦਾ ਜਨਮ ਦਿਨ ਮਨਾ ਰਹੇ ਸੀ ਜੀ ਉਸ ਛੋਟੇ ਜਿਹੇ ਇੱਕ ਅਸੀਂ ਘਰ ਪਾਰਟੀ ਦਾ ਆਯੋਜਨ ਕੀਤਾ ਉਸ ਪਾਰਟੀ ਵਿੱਚ ਅਸੀਂ ਭੋਜਨ ਦੇ ਵਿੱਚ ਪਾਉਣ ਲਈ ਪਨੀਰ ਦੀ ਡਿਮਾਂਡ ਕੀਤੀ ਸੀ ਇੱਕ ਜਮੈਂਟੋ ਵਾਲੇ ਨੂੰ ਅਸੀਂ ਉਹ ਜਮੈਂਟੋ ਵਾਲੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ ਉਹ ਕਿੰਨੇ ਸਮੇਂ ਤੱਕ ਸਾਡੇ ਕੋਲ ਸਾਡੇ ਘਰ ਵਿਖੇ ਪਨੀਰ ਸਾਨੂੰ ਉਹ ਡਿਲੀਵਰੀ ਕਰੇਗਾ ਅਗਰ ਸਾਡੇ ਕੋਲੇ ਪਨੀਰ ਸਮੇਂ ਦੇ ਨਾਲ ਡਿਲੀਵਰ ਹੋ ਜਾਂਦਾ ਹੈ ਤਾਂ ਅਸੀਂ ਉਸਦਾ ਇਸਤੇਮਾਲ ਭੋਜਨ ਵਿੱਚ ਕਰਕੇ ਅਸੀਂ ਪਾਰਟੀ ਦਾ ਵਧੀਆ ਆਯੋਜਨ ਕਰ ਸਕਦੇ ਹਾਂ ਜਿਹੜੇ ਵੀ ਬੱਚੇ ਰਿਸ਼ਤੇਦਾਰ ਭੈਣ ਭਰਾ ਸਾਡੇ ਕੋਲ ਆਏ ਹਨ ਉਹ ਇਸ ਭੋਜਨ ਦਾ ਖਾ ਕਰ ਪੂਰਾ ਪੂਰਾ ਆਨੰਦ ਲੈ ਸਕਣ ਹੁਣ ਅਸੀਂ ਬੇਸਬਰੀ ਦੇ ਨਾਲ ਇਸ ਜਮੈਂਟੋ ਵਾਲੇ ਦਾ ਇੰਤਜ਼ਾਰ ਕਰ ਰਹੇ ਹਾਂ ਵੀ ਉਹ ਸਾਡੇ ਕੋਲ ਕਦੋਂ ਪਹੁੰਚੇਗਾ ਹੁਣ ਅਸੀਂ ਫੋਨ 'ਤੇ ਪਤਾ ਕਰਦੇ ਹਾਂ ਕਿੱਥੇ ਪਹੁੰਚ ਰਿਹਾ ਉਹ ਕਿੰਨਾ ਸਮਾਂ ਲੱਗੇਗਾ ਹੈਲੋ ਹਾਂਜੀ ਤੁਸੀਂ ਜਮੈਂਟੋ ਵਾਲੇ ਬੋਲ ਰਹੇ ਹੋ ਜੀ ਆਹ ਤੁਹਾਨੂੰ ਇੱਕ ਅਸੀਂ ਆਰਡਰ ਕੀਤਾ ਸੀ ਅੱਜ ਸਾਡੀ ਬੇਟੀ ਦਾ ਜਨਮਦਿਨ ਹੈ ਉਹ ਜਨਮਦਿਨ ਅਤੇ ਅਸੀਂ ਤੁਹਾਥੋਂ ਪਨੀਰ ਦੀ ਡਿਮਾਂਡ ਕੀਤੀ ਸੀ ਉਹ ਅਸੀਂ ਲੇਟ ਹੋ ਰਹੇ ਹਾਂ ਪਾਰਟੀ ਦਾ ਸਮਾਂ ਹੋ ਰਿਹਾ ਤੁਸੀਂ ਹੁਣ ਕਿੱਥੇ ਪਹੁੰਚ ਗਏ ਹੋ ਅੱਛਾ ਆ ਰਹੇ ਹੋ ਕਿੰਨਾ ਸਮਾਂ ਲੱਗੇਗਾ ਪੱਚੀ ਮਿੰਟ ਆਜੋ ਤੁਸੀਂ ਨਵੇਂ ਕੋਟ ਰੋਡ ਤੋਂ ਅੱਗੇ ਕੇਸਰ ਸਿੰਘ ਵਕੀਲ ਵਾਲੀ ਗਲੀ ਆ ਉਸ ਦੇ ਵਿੱਚ ਆਓ ਐਫ ਬਲੋਕ ਆ ਉਹਦੇ ਵਿੱਚ ਐਫ ਬਲਾਕ ਦੇ ਵਿੱਚ ਹਾਊਸ ਨੰਬਰ ਛੇ ਸੌ ਦਸ ਅਤੇ ਰਣਜੀਤ ਸਿੰਘ ਜੀ ਮੇਰਾ ਨਾਂ ਉੱਥੇ ਪਹੁੰਚੋ ਅਤੇ ਸਾਨੂੰ ਇਹ ਪਨੀਰ ਦੀ ਡਿਲੀਵਰੀ ਕਰੋ ਤਾਂ ਕਿ ਅਸੀਂ ਪਾਰਟੀ ਦਾ ਆਯੋਜਨ ਵਧੀਆ ਤਰੀਕੇ ਨਾਲ ਕਰ ਸਕੀਏ ਧੰਨਵਾਦ ਜੀ